ਮੈਂ ਸਿੱਖ ਧਰਮ ਦੇ ਨਾਲ ਸੰਬੰਧਿਤ ਹਾਂ ਅਤੇ ਸਿੱਖ ਧਰਮ ਦੇ ਵਿੱਚ ਕਾਫੀ ਤਿਉਹਾਰ ਹਨ ਜਿਵੇਂ ਕਿ ਗੁਰਪੁਰਬ ਦਿਵਾਲੀ ਵਿਸਾਖੀ ਦਾ ਤਿਉਹਾਰ ਸ਼ਹੀਦੀ ਜੋੜ ਮੇਲੇ ਅਤੇ ਇਹਨਾਂ ਸਾਰਿਆਂ ਹੀ ਤਿਉਹਾਰਾਂ ਦੇ ਵਿੱਚ ਸਿੱਖ ਧਰਮ ਦੇ ਵਿੱਚ ਸ਼ੁੱਧ ਸ਼ਾਕਾਹਾਰੀ ਭੋਜਨ ਬਣਦਾ ਹੈ ਜਿਹਨਾਂ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਖੀਰਾਂ ਜਲੇਬੀਆਂ ਆਦਿ ਸ਼ਾਮਿਲ ਹਨ ਅਤੇ ਇਸ ਤੋਂ ਇਲਾਵਾ ਸ਼ੁੱਧ ਸਬਜ਼ੀਆਂ ਅਤੇ ਦਾਲਾਂ ਬਣਾਈਆਂ ਜਾਂਦੀਆਂ ਹਨ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਤਿਉਹਾਰ ਹਨ ਜੋ ਕਿ ਹਿੰਦੂ ਅਤੇ ਸਿੱਖ ਧਰਮ ਦੇ ਨਾਲ ਦੋਨਾਂ ਦੇ ਨਾਲ ਹੀ ਸੰਬੰਧਿਤ ਹਨ ਅਤੇ ਦੋਨਾਂ ਹੀ ਧਰਮਾਂ ਦੇ ਤਿਉਹਾਰਾਂ ਦੇ ਵਿੱਚ ਸ਼ੁੱਧ ਸ਼ਾਕਾਹਾਰੀ ਭੋਜਨ ਅਤੇ ਪਕਵਾਨ ਬਣਦੇ ਹਨ ਹਾਲਾਂਕਿ ਸਿੱਖ ਧਰਮ ਦੇ ਵਿੱਚ ਕੋਈ ਵੀ ਕਿਸੇ ਤਿਉਹਾਰ ਦੇ ਨਾਲ ਸੰਬੰਧਿਤ ਸਪੈਸ਼ਲ ਤਰ੍ਹਾਂ ਦਾ ਪਕਵਾਨ ਜਾਂ ਮਿਠਾਈ ਨਹੀਂ ਬਣਦੀ ਅਤੇ ਸਾਰੇ ਹੀ ਤਰ੍ਹਾਂ ਦੇ ਪਕਵਾਨ ਅਤੇ ਮਿਠਾਈਆਂ ਵਰਤੀਆਂ ਜਾਂਦੀਆਂ ਹਨ ਕੋਈ ਵੀ ਇੱਕ ਮਿਠਾਈ ਕਿਸੇ ਸਪੈਸ਼ਲ ਤਿਉਹਾਰ ਦੇ ਲਈ ਨਹੀਂ ਵਰਤੀ ਜਾਂਦੀ